ਸਿਹਤ ਪਰ ਸੰਭਾਲ ਪ੍ਰਣਾਲੀ ਨੂੰ ਬਹੁਤ ਤਰ੍ਹਾਂ ਨਾ ਨਾਲ ਫੰਡ ਦਿੱਤੇ ਜਾਂਦੇ ਹਨ ਅਤੇ ਇਹ ਫੰਡ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਇਹ ਫੰਡ ਸਿਹਤ ਸੰਭਾਲ ਦੇ ਖੇਤਰ ਵਿੱਚ ਬਹੁਤ ਸੁਧਾਰ ਕਰਨ ਲਈ ਕੰਮ ਆਉਂਦੇ ਹਨ ਅਤੇ ਇਹੀ ਫੰਡ ਸਿਹਤ ਸੰਭਾਲ ਬੀਮਾ ਕ ਦੇ ਨਾਮ ਤੋਂ ਜਾਨੇ ਜਾਂਦੇ ਹਨ ਇਹ ਫੰਡ ਸੇਵਾ ਸਿਹਤ ਸੇਵਾਵਾਂ ਨੂੰ ਵਧਾਉਣ ਲਈ ਕੀਤੇ ਜਾਂਦੇ ਹਨ ਸਿਹਤ ਸੇਵਾਵਾਂ ਜਿਵੇਂ ਹਸਪਤਾਲ ਮੈਡੀਕਲ ਵਗੈਰਾ ਵਿੱਚ ਇਹ ਸੇਵਾਵਾਂ ਰਾਹੀਂ ਔਰਤਾਂ ਬੱਚਿਆਂ ਦੀ ਸਿਹਤ ਦੇ ਲਈ ਸਹਾਇਤਾ ਦਿੰਦਾ ਹੈ ਇਸ ਤਰ੍ਹਾਂ ਇਹ ਸੁਧਾਰ ਹਰ ਤਰ੍ਹਾਂ ਵਿੱਚ ਮਦਦਗਾਰ ਹੁੰਦਾ ਹੈ ਇਹ ਫੰਡ ਸਰਕਾਰ ਦੁਆਰਾ ਅਨਾਥ ਆਸ਼ਰਮ ਵਿੱਚ ਬੱਚਿਆਂ ਨੂੰ ਅਤੇ ਗਰੀਬ ਲੋਕਾਂ ਨੂੰ ਦਿੱਤਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਜਿਸ ਤਰ੍ਹਾਂ ਗਰੀਬ ਲੋਕਾਂ ਨੂੰ ਸਿਹਤ ਵਿਭਾਗ ਬਾਰੇ ਜਿਆਦਾ ਨਹੀਂ ਪਤਾ ਹੁੰਦਾ ਉਹਨਾਂ ਲਈ ਸਰਕਾਰ ਵੱਖ ਵੱਖ ਥਾਵਾਂ 'ਤੇ ਕੈਂਪ ਵੀ ਲਗਾਉਂਦੀ ਹੈ ਅਤੇ ਉਹਨਾਂ ਕੈਂਪਾਂ ਵਿੱਚ ਗਰੀਬਾਂ ਨੂੰ ਮੁਫਤ ਅਤੇ ਘੱਟ ਪੈਸਿਆਂ ਵਿੱਚ ਇਲਾਜ ਦਿੱਤਾ ਜਾਂਦਾ ਹੈ ਜੇ ਲੋਕ ਜ਼ਿਆਦਾ ਖਰਚਾ ਨਹੀ ਕਰ ਸਕਦੇ ਸਰਕਾਰ ਉਹਨਾ ਨੂੰ ਇਸ ਲਈ ਬਣਾਈ ਕਾ ਈ ਕਾਰਡ ਬਣਾਏ ਜਾਂਦੇ ਹਨ ਜਿਸ ਰਾਹੀਂ ਉਹ ਵਿਅਕਤੀ ਦੇ ਇਲਾਜ ਵਿੱਚ ਪੈਸੇ ਦਿੱਤੇ ਜਾ ਸਕਣ ਕਈ ਲੋਕ ਜਿਹੜੇ ਪੈਸੇ ਨਹੀਂ ਦੇ ਸਕਦੇ ਇਲਾਜ ਲਈ ਉਹਨਾਂ ਨੂੰ ਇਸ ਵਿੱਚ ਮੁਫਤ ਇਲਾਜ ਵੀ ਦਿੱਤਾ ਜਾਂਦਾ ਹੈ ਇਸ ਕਾਰਡ ਵਿੱਚੋਂ ਪੈਸੇ ਸਰਕਾਰ ਦੁਆਰਾ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਸਰਕਾਰ ਲੋਕਾਂ ਲਈ ਵੱਖ ਵੱਖ ਜਗ੍ਹਾ ਕੈਂਪ ਲਗਾ ਕੇ ਮੁਫਤ ਇਲਾਜ ਕਰਦੀ ਹੈ ਕਈ ਵਾਰ ਟੈਸਟ ਮੁਫਤ ਜਾਂ ਘੱਟ ਰੇਟ 'ਤੇ ਕਰਤੇ ਜਾ ਸਕਦੇ ਹਨ ਸਰਕਾਰ ਸਿਹਤ ਸੰਭਾਲ ਵਿੱਚ ਬਹੁਤ ਯੋਗਦਾਨ ਪਾਉਂਦੀ ਹੈ ਅਤੇ ਮੈਂ ਵੀ ਇਸ ਕਾ ਈ ਕਾਰਡ ਦਾ ਫਾਇਦਾ ਉਠਾਇਆ ਹੈ